ਖਾਲਿਸਤਾਨ ਸਿੱਖਾਂ ਦੇ ਵਿੱਚ ਖਾਲਿਸਤਾਨ ਇੱਕ ਸਿੱਖਾਂ ਦੁਆਰਾ ਬਨਾਇਆ ਗਿਆ ਹੈ ਜੋ ਕੇ ਖਾਲਿਸਤਾਨ ਬਨਾਇਆ ਹੈ ਖਾਲਿਸਤਾਨ ਜੈਸੇ ਕੀ ਇੰਦਰਾਂ ਗਾਂਧੀ ਨੇ ਉੱਨੀ ਸੌ ਨੱਬੇ ਈਸਵੀਂ ਵਿੱਚ ਉਹਨਾਂ ਨੇ ਉਹ ਖਾਲਿਸਤਾਨ ਨੂੰ ਨਹੀਂ ਚੱਲਣ ਦਿੱਤਾ ਉਹਨਾਂ ਨੇ ਬਈ ਉਹਨਾਂ ਨੇ ਬਹੁਤ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਣ ਅੰਮ੍ਰਿਤਪਾਲ ਨੇ ਇਸ ਖਾਲਿਸਥਾਨ ਨੂੰ ਇੱਕ ਅਲੱਗ ਸਿਟੀ ਜਿਵੇਂ ਕੀ ਬਨਾਉਣਾ ਚਾਹੁੰਦੇ ਸੀ ਖਾਲਿਸਥਾਨ ਜਿਵੇਂ ਉੱਤਰੀ ਬਾਰਤ ਉੱਤਰੀ ਭਾਰਤ ਦੇ ਵਿੱਚ ਹੈ ਹੈ ਜਿਵੇਂ ਕੀ ਉਸ ਨਹਿਰ ਨਹਿਰਾਂ ਕੱਢਿਆ ਗਈਆਂ ਸੀ ਸੀਗੀ ਪੰਜਾਬ ਦੇ ਸਾਰੇ ਇਲਾਕਿਆਂ ਨੂੰ ਪਾਣੀ ਦਿੱਤਾ ਜਾਵੇ ਰਾਜਨੀਤਿਕ ਅਤੇ ਸਮਾਜਿਕ ਪ੍ਰਭਾਵ ਵੀ ਇਨ ਦੇ ਉੱਤੇ ਪਏ ਹਨ ਕੋਈ ਕਹਿੰਦਾ ਕੇ ਮੈਂ ਇਸ ਦਾ ਹੱਕਦਾਰ ਹਾਂ ਤੇ ਕੋਈ ਕੀ ਕਹਿੰਦਾ ਸਮਾਜ ਉੱਤੇ ਅਲੱਗ ਅਲੱਗ ਲੋਕਾਂ ਤੇ ਉਹਨਾਂ ਦਾ ਅਸਰ ਹੈ ਕੀ ਹਰ ਲੋਕ ਆਏ ਕੀ ਆਗੇ ਮੈਂ ਰਾਜਨੀਤੀ ਕਰਨੀ ਆ ਉਹ ਕਹਿੰਦਾ ਮੈਂ ਰਾਜਨੀਤੀ ਕਰਨੀ ਐ ਇਸ ਕਰਕੇ ਖਾਲਿਸਤਾਨ ਨਹਿਰ ਪੈਦਾ ਹੋਈ ਤੇ ਇਸ ਦੇ ਮੁੱਖ ਉਦੇਸ਼ ਸੀ ਕੀ ਮੈਂ ਰਾਜਨੀਤੀ ਸਮਾਜਿਕ ਮਤਬਲ ਉਹ ਕਰਾਂ ਬਈ ਕਾਰਿਆਂ ਕਰਾਂ ਬਹੁਤ ਸਾਰੇ ਕੰਮ ਕਰਾਂ ਤਾਂ ਕੀ ਸਾਨੂੰ ਵੀ ਪਾਣੀ ਮਿਲ ਸਕੇ ਇਸ ਦੁਆਰਾ ਬਾਰੇ ਬਹੁਤ ਸਾਰੀ ਚਰਚਾ ਕੀਤੀ ਸੀ ਤੇ ਇਹ ਸਾਡੀ ਚਰਚਾ ਹੋ ਗਈ ਸੀ